ਹਾਂਜੀ ਅਸੀਂ ਹੈ ਨਾ ਅਜਿਹੀ ਬਹੁਤ ਚੀਜ਼ ਬਣਾਈ ਆ ਜਿਹੜਾ ਸਾਨੂੰ ਬਾਅਦ 'ਚ ਅਹਿਸਾਸ ਹੋਇਆ ਵੀ ਇਹਦਾ ਡੂੰਘਾ ਅਰਥ ਜਿਹੜਾ ਜਾਂ ਇਹਦਾ ਬਹੁਤ ਜ਼ਿਆਦਾ ਮਹੱਤਵ ਆ ਫੋਰ ਇਗਜਾਮਪਲ ਪਹਿਲਾਂ ਅਸੀਂ ਕੜਾਹ ਪ੍ਰਸ਼ਾਦ ਬਣਾਉਂਦੇ ਹੁੰਦੇ ਸੀ ਉਹਨੂੰ ਹੁਣ ਕੜਾਹ ਪ੍ਰਸ਼ਾਦ ਨੂੰ ਅਸੀਂ ਦੇਗ ਦਾ ਨਾਂ ਵੀ ਕਿਹਾ ਜਾਂਦਾ ਕੜਾਹ ਪ੍ਰਸ਼ਾਦ ਪਹਿਲਾਂ ਬਣਾ ਕੇ ਜਦੋਂ ਛੱਕਦੇ ਹੁੰਦੇ ਸੀ ਸਾਨੂੰ ਵਧੀਆ ਲੱਗਦਾ ਸੀ ਅਸੀਂ ਇਹ ਵੀ ਨਹੀਂ ਸੀ ਕਹਿੰਦੇ ਵੀ ਉਹਨੂੰ ਛਕਣਾ ਕਿਹਾ ਜਾਂਦਾ ਬਸ ਅਸੀਂ ਇਹਨੂੰ ਖਾਂਦੇ ਕਹਿੰਦੇ ਹੁੰਦੇ ਸੀਗੇ ਅਤੇ ਬਾਅਦ 'ਚ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਵੀ ਖਾਂਦੀਆਂ ਤਾਂ ਡੈਣਾਂ ਹੁੰਦੀਆਂ ਨੇ ਇਹਨੂੰ ਸਿੱਖਾਂ ਦੇ ਵਿੱਚ ਛਕਣਾ ਹੀ ਕਿਹਾ ਜਾਂਦਾ ਵੀ ਜਿਹੜੀ ਕੜਾ ਕੜਾਹ ਪ੍ਰਸ਼ਾਦ ਅਸੀਂ ਜਦੋਂ ਵੀ ਕੋਈ ਵੀ ਜੰਗ ਲੜਨ ਜਾਂਦੇ ਹੁੰਦੇ ਸੀ ਸਿੰਘ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਕੜਾਹ ਪ੍ਰਸ਼ਾਦ ਬਣਾ ਕੇ ਅਰਦਾਸ ਕਰਕੇ ਮੱਥਾ ਟੇਕਦੇ ਹੁੰਦੇ ਸੀਗੇ ਤਾਂ ਜੋ ਵੀ ਉਹਨੂੰ ਛੱਕ ਕੇ ਉਹਨਾਂ ਦੇ ਅੰਦਰ ਹੋਰ ਵੀ ਜਿਹੜੀ ਪਾਵਰ ਆ ਉਹ ਆ ਸਕੇ